ਟੈਕਨੋਲਜੀ ਇੱਕ ਬਹੁਤ ਵਧੀਆ ਚੀਜ਼ ਹੈ ਅੱਜ ਕੱਲ੍ਹ ਬਹੁਤ ਵਧੀਆ ਵਧੀਆ ਟੈਕਨੋਲਜੀਆਂ ਆਈਆਂ ਹਨ ਜਿਵੇਂ ਕਿ ਨਵੇਂ ਨਵੇਂ ਰਿਵਾਜ਼ ਦੀਆਂ ਚੀਜ਼ਾਂ ਹੁੰਦੀਆਂ ਹਨ ਅਲੱਗ ਅਲੱਗ ਤਰ੍ਹਾਂ ਦੀਆਂ ਮਸ਼ੀਨਾਂ ਆ ਗਈਆਂ ਹਨ ਆਨਲਾਈਨ ਕੰਮ ਹੋ ਰਹੇ ਹਨ ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਹਨ ਲੋਕ ਟੈਕਨੋਲੋਜੀ ਨਾਲ ਬਹੁਤ ਫਾਇਦੇਮੰਦ ਵਿੱਚ ਰਹਿੰਦੇ ਹਨ ਓਹ ਹੁਣ ਆਪਣਾ ਸਾਰਾ ਕੰਮ ਬਹੁਤ ਹੀ ਆਸਾਨੀ ਨਾਲ ਕਰ ਲੈਂਦੇ ਹਨ ਅਲੱਗ ਅਲੱਗ ਤਰ੍ਹਾਂ ਦੀਆਂ ਮਸ਼ੀਨਾਂ ਆ ਗਈਆਂ ਹਨ ਨਵੇਂ ਏ ਸੀ ਆ ਗਏ ਹਨ ਜਿਸ ਕਾਰਨ ਲੋਕ ਬਹੁਤ ਅਨੰਦ ਲੈਂਦੇ ਹਨ ਟੈਕਨੋਲਜੀ ਨੇ ਨਿਊਜ਼ ਦਾ ਬਹੁਤ ਮਦਦ ਕੀਤੀ ਹੈ ਟੈਕਨੋਲਜੀ ਜਿੱਥੋਂ ਜਿੱਥੋਂ ਵੀ ਕੋਈ ਚੀਜ਼ ਇਕੱਠਾ ਹੁੰਦੀ ਹੈ ਉਹ ਸਭ ਫੋਨ 'ਤੇ ਆ ਜਾਂਦੀ ਹੈ ਅਤੇ ਨਿਊਜ਼ ਵਿੱਚ ਚਲੀ ਜਾਂਦੀ ਹੈ ਜਿਸ ਨਾਲ ਲੋਕਾਂ ਨੂੰ ਹਰ ਇੱਕ ਚੀਜ਼ ਦਾ ਪਤਾ ਲੱਗ ਜਾਂਦਾ ਹੈ ਜਿਵੇਂ ਕਿਸੇ ਦਾ ਐਕਸੀਡੈਂਟ ਹੋਇਆ ਹੈ ਉਹ ਖਬਰ ਨਿਊਜ਼ ਵਿੱਚ ਆ ਜਾਂਦੀ ਹੈ ਅਤੇ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਨਿਊਜ਼ ਵਿੱਚ ਲੋਕ ਬਹੁਤ ਸਾਰੀਆਂ ਚੀਜ਼ਾਂ ਵੇਖਦੇ ਹਨ